ਹੈਲੋ ਹਾਂ ਕਿੱਦਾਂ ਹਰਸ਼ ਬਸ ਵਧੀਆ ਕਿੱਦਾਂ ਘਰਦੇ ਕਿੱਦਾਂ ਸਭ ਮੰਮਾ ਪਾਪਾ ਮੰਮਾ ਪਾਪਾ ਕਿੱਦਾਂ ਮੈਂ ਬਸ ਕੋਲੇਜ ਆਈ ਹਾਂ ਤੂੰ ਕੀ ਕਰਦਾ ਅੱਛਾ ਤਾਂਹੀ ਯਾਦ ਕਰ ਲਿਆ ਹਾਂ ਹਾਂ ਠੀਕ ਹੈ ਹੋਰ ਪੜ੍ਹਾਈ ਕਿੱਦਾਂ ਚੱਲਦੀ ਅੱਛਾ ਮੈਂ ਵੈਸੇ ਵੀ ਕਰਨਾ ਸੀ ਕਾਲ ਮੈਂ ਇੱਕ ਗੁੱਡ ਨਿਊਜ਼ ਦੇਣੀ ਸੀ ਘਰੇ ਹਾਂ ਕਿ ਮੈਨੂੰ ਦੁਬਈ ਜੋਬ ਮਿਲ ਗਈ ਆ ਹਾਂ ਹਾਂਜੀ ਹਾਂਜੀ ਥੈਂਕ ਯੂ ਹਮ ਹੁਣ ਦੁਬਈ ਚਲ ਜਾਣਾ ਨਹੀਂ ਦੁਬਈ ਵਧੀਆ ਸੀਗਾ ਸਭ ਕੁਝ ਉਹਨਾਂ ਵੱਲੋਂ ਹੀ ਹੋਣਾ ਸੀ ਔਰ ਇਨਕਮ ਵੀ ਵਧੀਆ ਸੀ ਇੰਡੀਆ 'ਚ ਹੀ ਮਿਲਣਾ ਸਿੱਧਾ ਹਮ ਹਾਂ ਮੰਥਲੀ ਦੋ ਦੋ ਲੱਖ ਆ ਰੂਮ ਵੀ ਉਹਨਾਂ ਵੱਲੋਂ ਹੀ ਆ ਕੰਪਨੀ ਵੱਲੋਂ ਹੀ ਆ ਰੂਮ ਖਾਣਾ ਵਗੈਰਾ ਸਭ ਇੰਨਕਲਿਊਡ ਆ ਹਾਂ

ਹਾਂ ਵਧੀਆ ਵਾ ਦੁਬਈ ਤਾਂ ਬਹੁਤ ਵਧੀਆ ਵਾ ਹਮ ਨਹੀਂ ਯਾਰ ਇੱਥੇ ਇਨਕਮ ਨਹੀਂ ਨਾ ਇੰਨੀ ਮਿਲਣੀ ਸੀ ਨਾ ਕੋਈ ਇੱਦਾਂ ਦੀ ਇੰਨਕਲਿਊਡਿੰਗ ਚੀਜ਼ਾਂ ਮਿਲਣੀਆਂ ਸੀ ਬਸ ਚਲ ਜਾਣਾ ਮੈਂ ਤਿੰਨ ਚਾਰ ਮਹੀਨਿਆਂ ਤੱਕ ਘਰ ਆ ਜਾਣਾ ਮੈਂ ਹੁਣ ਦੋ ਤਿੰਨ ਦਿਨਾਂ ਤੱਕ ਆ ਜਾਣਾ ਹੁਣ ਬਸ ਪੜ੍ਹਾਈ ਵੀ ਖ਼ਤਮ ਹੋ ਗਈ ਆ

ਠੀਕ ਹੈ ਮੰਮਾ ਪਾਪਾ ਨਾਲ ਕਰਾ ਦੇ ਠੀਕ ਹੈ ਓਕੇ ਠੀਕ ਹੈ ਓਕੇ ਬਾਏ ਬਾਏ